ਮਾਸ਼ਾ ਜ਼ਿਲ੍ਹੇ ਵਿੱਚ ਬਹੁਤ ਵਧੀਆ ਹੋਸਪਿਟਲ ਹਨ ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਈਵੇਟ ਹੋਸਪੀਟਲ ਅਪਦਬੰਧ ਹਨ ਜਿਸ ਵੀ ਪ੍ਰਾਈਵੇਟ ਪ੍ਰਾਈਵੇਟ ਹੋਸਪੀਟਲ ਵਿੱਚ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਜਿਸ ਵਿੱਚ ਆਮ ਲੋਕ ਆਮ ਲੋਕ ਆਪਣਾ ਕੋਈ ਆਪਣਾ ਕੋਈ ਟਰੀਟਮੈਂਟ ਵਗੈਰਾ ਨਹੀਂ ਕਰਵਾ ਸਕਦੇ ਅਤੇ ਸਰਕਾਰੀ ਹੋਸਪਿਟਲ ਜੀ ਅੱਜ ਕੱਲ੍ਹ ਬਹੁਤ ਵਧੀਆ ਬਣ ਚੁੱਕੇ ਹਨ ਜਿੱਥੇ ਲੋਕ ਆਪਣੇ ਟੈਸਟ ਟੈਸਟ ਟੈਸਟ ਬਲੱਡ ਟੈਸਟ ਐਕਸ ਰੇ ਸੀ ਟੀ ਸਕੈਨ ਆਦਿ ਕਰਵਾ ਸਕਦੇ ਹਨ ਇਥੋਂ ਦੇ ਡੋਕਟਰ ਇੱਥੋਂ ਦੇ ਅਲੱਗ ਅਲੱਗ ਤਰ੍ਹਾਂ ਦੇ ਡੋਕਟਰ ਹਨ ਜਿਵੇਂ ਸਕਿੱਨ ਹੱਡੀਆਂ ਦੇ ਪੇਟ ਅਤੇ ਦਿਮਾਗ ਜਿਸ ਨੂੰ ਸਕਿੱਨ ਦੀ ਜਿਸਨੂੰ ਕਿਸੇ ਨੂੰ ਐਲਰਜੀ ਦੀ ਪ੍ਰੋਬਲਮ ਹੋਵੇ ਤਾਂ ਉਹ ਸਕਿੱਨ ਵਾਲੇ ਡੋਕਟਰ ਕੋਲ ਜਾ ਸਕਦਾ ਅਤੇ ਹੱਡੀਆਂ ਜਿਸ ਦੀ ਕੋਈ ਲੱਤ ਬਾਂਹ ਟੁੱਟੀ ਹੋਵੇ ਤਾਂ ਉਸਨੂੰ ਹੱਡੀਆਂ ਵਾਲੇ ਡੋਕਟਰ ਕੋਲ ਜਾਣਾ ਚਾਹੀਦਾ ਹੈ ਜਿਸ ਨੂੰ ਜਿਸ ਨੂੰ ਕੋਈ ਜਿਸ ਨੂੰ ਕੋਈ ਡਿਪਰੈਸ਼ਨ ਵਗੈਰਾ ਹੈ ਤਾਂ ਉਹ ਦਿਮਾਗ ਵਾਲੇ ਡੋਕਟਰ ਕੋਲ ਜਾ ਸਕਦਾ ਹੈ ਇੱਥੇ ਹਰ ਤਰ੍ਹਾਂ ਦੀ ਫਰੀ ਮੈਡੀਸਨ ਮਿਲਦੀ ਹੈ ਅਤੇ ਐਮਰਜੈਂਸੀ ਵਾਰਡ ਵਿੱਚ ਬਹੁਤ ਵਧੀਆ ਹੀ ਕੇਅਰ ਕੇਅਰ ਹੈ ਅਤੇ ਬਹੁਤ ਹੀ ਜ਼ਿਆਦਾ ਨਰਸ ਵੀ ਨਰਸ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਕੇਅਰ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਐਡਮਿਟ ਲੋਕ ਵੀ ਬਹੁਤ ਵਧੀਆ ਵਧੀਆ ਕ ਕੇਅਰ ਕਰਦੇ ਹਨ ਐਡਮਿਟ ਦੀ ਬਹੁਤ ਜ਼ਿਆਦਾ ਵਧੀਆ ਕੇਅਰ ਕਰਦੇ ਹਨ ਸਰਕਾਰੀ ਹੋਸਪੀਟਲ ਬਹੁਤ ਹੀ ਅੱਜ ਕੱਲ੍ਹ ਦੇ ਬਹੁਤ ਹੀ ਜ਼ਿਆਦਾ ਵਧੀਆ ਬਣ ਚੁੱਕੇ ਹਨ ਜਿਸ ਨਾਲ਼ ਆਮ ਲੋਕ ਆਮ ਲੋਕ ਨੂੰ ਵੀ ਬਹੁਤ ਜ਼ਿਆਦਾ ਵਧੀਆ ਹੋ ਗਿਆ ਹੈ